ਮੈਂ ਅੱਜ ਸੰਗੀਤ ਉਤਸਵ ਵਿੱਚ ਹਿੱਸਾ ਲੈਣ ਲਈ ਬਹੁਤ ਖੁਸ਼ ਹਾਂ ਅਤੇ ਮੈਂ ਇਸ ਦੀ ਕਾਫੀ ਦੇਰ ਤੋਂ ਤਿਆਰੀ ਕਰ ਰਿਹਾ ਸੀ ਮੈਂ ਬਹੁਤ ਹੀ ਤਿਆਰੀ ਕੀਤੀ ਹੈ ਅਤੇ ਮਿਹਨਤ ਨਾਲ ਲਗਨ ਨਾਲ ਇਸ ਨੂੰ ਪ੍ਰਾਪਤ ਕੀਤਾ ਹੈ ਮੈਂ ਤਿੰਨ ਚਾਰ ਗੀਤ ਤਿਆਰ ਕੀਤੇ ਹਨ ਅਤੇ ਇਸ ਵਾਰ ਮੈਨੂੰ ਉਮੀਦ ਹੈ ਕਿ ਮੈਂ ਹੀ ਜਿੱਤਾਂਗਾ ਇਸ ਵਾਰ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਤੇ ਆਪਣੇ ਟਿਕਟ ਪਲੇਟਫਾਰਮ ਨੰਬਰ ਇੱਕ ਤੋਂ ਲੁਧਿਆਣੇ ਤੋਂ ਸ਼ੁ ਹੈ ਉੱਥੇ ਆਪਾਂ ਇੱਕ ਵਾਰੀ ਪਲੈਟਫਾਰਮ ਦੇ ਹੈਡ ਤੋਂ ਆਪਣੀ ਟਿਕਟ ਕਨਫਰਮ ਕਰਾਵਾਂਗੇ ਮੈਂ ਤਿਆਰ ਹਾਂ ਅਤੇ ਮੈਂ ਘਰੋਂ ਤੁਰਨ ਲੱਗਾ ਹਾਂ ਉਮੀਦ ਹੈ ਕਿ ਤੂੰ ਵੀ ਤਿਆਰ ਹੋਏਂਗਾ ਅਸੀਂ ਉੱਥੇ ਜਾ ਕੇ ਮਿਲਦੇ ਹਾਂ